ਮੇਰੇ ਇਲਾਕੇ ਦੇ ਲੋਕ ਜ਼ਿਆਦਾਤਰ ਗੁਰਦੁਆਰੇ ਜਾਂਦੇ ਹਨ ਤਰਨ ਤਾਰਨ ਵਿੱਚ ਇੱਕ ਗੁਰਦੁਆਰਾ ਹੈ ਜਿੱਥੇ ਲੋਕ ਸਵੇਰੇ ਸ਼ਾਮ ਰਾਤ ਦਿਨ ਵਿੱਚ ਇੱਕ ਵਾਰ ਤਾਂ ਜ਼ਰੂਰ ਜਾਂਦੇ ਹਨ ਬਾਕੀ ਲੋਕ ਜਿਹੜੇ ਨੇ ਉਹ ਸਿੱਖਾਂ ਦਾ ਜਿਹੜਾ ਧਾਰਮਿਕ ਸਥਲ ਹੈ ਜਿਹਨੂੰ ਗੋਲਡਨ ਟੈਂਪਲ ਸਵਰਨ ਮੰਦਿਰ ਜਾਂ ਸਵਰਨ ਗੁਰਦੁਆਰਾ ਵੀ ਕਹਿੰਦੇ ਨੇ ਜਿਨ੍ਹਾਂ ਦੀ ਨੀਂਹ ਸਿੱਖਾਂ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਪੀਰ ਜਾਂ ਕਹਿ ਸਕਦੇ ਇੱਕ ਮੁਸਲਮਾਨ ਸਾਈ ਮੀਆਂ ਮੀਰ ਦੁਆਰਾ ਉਸਦੀ ਨੀਂਹ ਰਖਵਾਈ ਸੀਗੀ ਕੁਛ ਜਾਤੀ ਦੇ ਲੋਕਾਂ ਨੂੰ ਜਿੱਦਾਂ ਜਿਹੜੇ ਛੋਟੀ ਜਾਤ ਦੇ ਹੁੰਦੇ ਨੇ ਉਹਨਾਂ ਨੂੰ ਕਈ ਮੰਦਿਰਾਂ ਵਿੱਚ ਜਾਣ ਤੋਂ ਰੋਕਿਆ ਜਾਂਦਾ ਹੈ ਕਿ ਕਹਿੰਦੇ ਨੇ ਕਿ ਤੁਸੀਂ ਛੋਟੀ ਜਾਤੀ ਦੇ ਤੁਸੀਂ ਐਸ ਗੁਰਦੁਆਰੇ ਨਹੀਂ ਜਾ ਸਕਦੇ ਇਸ ਮੰਦਿਰ ਨਹੀਂ ਜਾ ਸਕਦੇ ਪਰ ਜਿਹੜਾ ਗੋਲਡਨ ਟੈਂਪਲ ਆ ਉਹਦੇ ਦਰਵਾਜ਼ੇ ਚਾਰੇ ਜਾਤੀਆਂ ਦੇ ਲੋਕਾਂ ਵਾਸਤੇ ਖੁੱਲ੍ਹੇ ਨੇ ਚਾਹੇ ਉਹ ਸਿੱਖ ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਹਿੰਦੂ ਹੋਵੇ ਇਸੇ ਕਰਕੇ ਹੀ ਗੁਰੂ ਅਰ ਗੁਰੂ ਅਰਜਨ ਦੇਵ ਜੀ ਨੇ ਇਸ ਗੁਰਦੁਆਰੇ ਦੀ ਨੇਕ ਪੀਰ ਰਾਹੀਂ ਰਖਵਾਈ ਸੀਗੀ ਤਾਂ ਕਿ ਲੋਕ ਗੋਲਡਨ ਟੈਂਪਲ ਬਾਰੇ ਇਹ ਨਾ ਕਹਿਣ ਕਿ ਸਿਰਫ਼ ਸਿੱਖਾਂ ਦਾ ਇੱਥੇ ਸਿੱਖ ਹੀ ਜਾ ਸਕਦੇ ਜੇ ਇੱਥੇ ਮੁਸਲਮਾਨ ਨਹੀਂ ਜਾ ਸਕਦੇ ਇਹ ਗੁਰਦੁਆਰਾ ਚਾਰ ਸੌ ਸਾਲ ਪੁਰਾਣਾ ਹੈ ਇਸ ਗੁਰਦੁਆਰੇ ਦਾ ਜਿਹੜਾ ਸਰੋਵਰ ਹੈ ਉਹਦੇ ਆਲੇ ਦੁਆਲੇ ਹੀ ਪੂਰਾ ਅੰਮ੍ਰਿਤਸਰ ਸਥਾਪਿਤ ਹੈ ਇਹ ਗੁਰਦੁਆਰਾ ਬਹੁਤ ਇਸ ਗੁਰਦੁਆਰੇ ਦਾ ਸਰੋਵਰ ਨੂੰ ਸਭ ਤੋਂ ਵੱਡਾ ਸਰੋਵਰ ਆਖਿਆ ਜਾਂਦਾ ਹੈ ਬਾਕੀ ਕੁਛ ਲੋਕ ਹੋਰ ਵੀ ਗੁਰਦੁਆਰੇ ਜਾਂਦੇ ਹਨ ਜਿਵੇਂ ਕਿ ਦਿੱਲੀ ਦੇ ਬੰਗਲਾ ਸਾਹਿਬ ਫਿਰ ਅੰਮ੍ਰਿਤਸਰ ਦਾ ਟਾਹਲਾ ਸਾਹਿਬ ਇੱਦਾਂ ਕਰਕੇ ਮੇਰੇ ਇਲਾਕੇ ਦੇ ਲੋਕ ਅਲੱਗ ਅਲੱਗ ਗੁਰਦੁਆਰੇ ਜਾਂਦੇ ਹਨ